ਹੈਲੋ ਤੁਸੀਂ ਓਲਾ ਤੋਂ ਬੋਲ ਰਹੇ ਹੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀ ਕਾਰ ਬੁੱਕ ਕੀਤੀ ਸੀ ਅਸੀਂ ਆਪਣੇ ਪਿੰਡ ਤੋਂ ਜਲੰਧਰ ਘੁੰਮਣ ਜਾਣਾ ਸੀ ਜਿਸ ਵਿੱਚ ਸਾਡੇ ਘਰ ਦੇ ਦਸ ਮੈਂਬਰ ਜਾਣੇ ਸਨ ਅਸੀਂ ਸਾਰੇ ਮੈਂਬਰ ਤਿਆਰ ਹੋ ਕੇ ਖੜ੍ਹੇ ਹਾਂ ਪਰ ਤੁਹਾਡਾ ਡਰਾਈਵਰ ਕਾਰ ਲੈ ਕੇ ਅਜੇ ਤੱਕ ਸਾਡੇ ਕੋਲ ਨਹੀਂ ਆਇਆ ਅਸੀਂ ਦੋ ਵਜੇ ਦਾ ਸਮਾਂ ਦਿੱਤਾ ਸੀ ਪਰ ਡਰਾਈਵਰ ਅਜੇ ਤੱਕ ਨਹੀਂ ਆਇਆ ਹੈ ਮੈਂ ਤੁਹਾਨੂੰ ਇਸ ਲਈ ਫੋਨ ਕੀਤਾ ਹੈ ਕਿ ਤੁਹਾਡਾ ਡਰਾਈਵਰ ਨਹੀਂ ਆਇਆ ਅਤੇ ਅਸੀਂ ਤੁਹਾਡੀ ਕਾਰ ਜਿਹੜੀ ਅਸੀਂ ਬੁੱਕ ਕੀਤੀ ਸੀ ਉਸ ਨੂੰ ਰੱਦ ਕਰ ਦਿਓ ਅਸੀਂ ਕੋਈ ਹੋਰ ਕਾਰ ਲੈ ਕੇ ਚਲੇ ਜਾਵਾਂਗੇ ਕਿਉਂਕਿ ਸਮਾਂ ਬਹੁਤ ਹੋ ਗਿਆ ਹੈ ਅਤੇ ਅਸੀਂ ਵਾਪਸ ਵੀ ਮੁੜਨਾ ਹੈ ਕਿਰਪਾ ਕਰਕੇ ਸਾਡੀ ਕਾਰ ਰੱਦ ਕਰ ਦਿਓ ਜੇ ਤੁਸੀਂ ਨਹੀਂ ਭੇਜ ਸਕਦੇ ਅਤੇ ਸਾਡੇ ਪੈਸੇ ਵੀ ਵਾਪਸ ਕਰ ਦਿਓ